ਕੀਤਾ ਜਾਂਦਾ ਹੈ ਭੰਗੜਾ ਬੋਲੀਆਂ ਅਤੇ ਢੋਲ ਦੀ ਧੁੰਨ ਅਨੁਸਾਰ ਪਾਇਆ ਜਾਂਦਾ ਹੈ ਇਹ ਗੱਭਰੂ ਜਵਾਨ ਮਿਲ ਕੇ ਆਪਸ ਵਿੱਚ ਜੋਟੀਆਂ ਬਣਾ ਕੇ ਪਾਉਂਦੇ ਸਨ ਆਮ ਤੌਰ 'ਤੇ ਭੰਗੜਾ ਸੰਗੀਤ ਦੀ ਵਿਸ਼ੇਸ਼ਤਾ ਰਿਹਾ ਹੈ ਪੰਜਾਬੀ ਨਾਚ ਭੰਗੜਾ ਇੱਕ ਸੱਭਿਆਚਾਰਿਕ ਅਤੇ ਸੰਪਰਦਾਇਕ ਜਸ਼ਨ ਵਜੋਂ ਪੰਜਾਬੀ ਕਿਸਾਨਾਂ ਨਾਲ ਸ਼ੁਰੂ ਹੋਇਆ ਇਸ ਦੇ ਅਨੁਸਾਰ ਸਮੇਂ ਦੇ ਵਿਕਾਸ ਨੇ ਭੰਗੜੇ ਨੂੰ ਆਪਣੇ ਰਵਾਇਤੀ ਪੰਜਾਬੀ ਜੜ੍ਹਾਂ ਨੂੰ ਬਰਕਰਾਰ ਰੱਖਣ ਦੀ ਇਜਾਜ਼ਤ ਦਿੱਤੀ ਹੈ ਭੰਗੜਾ ਨੌਜਵਾਨ ਰਲ ਮਿਲ ਕੇ ਪਾਉਂਦੇ ਹਨ ਇਹ ਇੱਕ ਦੂਜੇ ਨੂੰ ਇਸ਼ਾਰੇ ਕਰਕੇ ਪਾਉਂਦੇ ਹਨ ਇਹ ਬਹੁਤ ਹੀ ਸੋਹਣੀਆਂ ਪੱਗਾਂ 'ਤੇ ਬੰਨ੍ਹ ਕੇ ਆਪਸ ਵਿੱਚ ਰਲ ਮਿਲ ਕੇ ਭੰਗੜਾ ਪਾਉਂਦੇ ਹਨ ਇਹ ਭੰਗੜਾ ਇੱਕ ਦੂਜੇ ਵੱਲੋਂ ਪਾਇਆ ਜਾਂਦਾ ਹੈ ਪੰਜਾਬੀ ਸੱਭਿਆਚਾਰ ਕਦੇ ਤਿਉਹਾਰਾਂ ਵਿੱਚ ਇਸ ਨੇ ਮਹੱਤਵਪੂਰਨ ਹਿੱਸਾ ਪਾਇਆ ਹੈ ਪੰਜਾਬੀ ਸੱਭਿਆਚਾਰਕ ਵਿੱਚ ਇਸ ਭੰਗੜੇ ਦੀ ਬਹੁਤ ਜ਼ਿਆਦਾ ਮਹੱਤਤਾ ਰਹੀ ਹੈ ਆਪਣੀ ਰਵਾਇਤੀ ਪੰਜਾਬੀ ਜੜ੍ਹਾਂ ਨੂੰ ਬਰਕਰਾਰ ਰੱਖਣ ਦੀ ਇਜਾਜ਼ਤ ਦਿੱਤੀ ਹੈ ਇੱਥੋਂ ਤੱਕ ਕਿ ਸਕੂਲਾਂ ਵਿੱਚ ਕਸਰਤ ਅਤੇ ਡਾਂਸ ਪ੍ਰੋਗਰਾਮ ਵਿੱਚ ਏਕੀਕਰਨ ਸ਼ਾਮਿਲ ਕੀਤਾ ਹੈ ਤਿਉਹਾਰ ਨਾਲ ਜੁੜਿਆ ਹੋਇਆ ਹੈ ਅਪ੍ਰੈਲ ਅਤੇ ਮਈ ਦੇ ਮੌਸਮ ਦੌਰਾਨ ਕੀਤਾ ਜਾਂਦਾ ਹੈ ਭੰਗੜਾ ਬੋਲੀਆਂ ਅਤੇ ਢੋਲ ਦੀ ਧੁੰਨ ਅਨੁਸਾਰ ਹੀ ਪਾਇਆ ਜਾਂਦਾ ਹੈ